ਬਚਪਨ ਵਿੱਚ ਅਸੀਂ ਬਹੁਤ ਸਾਰੀਆਂ ਖੇਡਾਂ ਖੇਡਦੇ ਸਨ ਜਿਨ੍ਹਾਂ ਨਾਲ਼ ਸਾਡਾ ਮਨੋਰੰਜਨ ਹੁੰਦਾ ਸੀ ਅਸੀਂ ਬਚਪਨ ਦੇ ਵਿੱਚ ਅਸੀਂ ਸਾਰੀਆਂ ਕੁੜੀਆਂ ਰਲ਼ ਕੇ ਪੀਚੋ ਖੇਡਦੀਆਂ ਸੀ ਕਿੱਕਲੀ ਖੇਡਦੀਆਂ ਸੀ ਪਿੱਠੂ ਗਰਮ ਪਿੱਠੂ ਖੇਡਦੇ ਸੀਗੇ ਬਾਰਾਂ ਵੀਟੀ ਖੇਡਦੇ ਸੀਗੇ ਪਿੱਠੂ ਦੇ ਵਿੱਚ ਇੱਕ ਸਰੀਏ ਦੇ ਨਾਲ਼ ਰੱਸੀ ਬੰਨ੍ਹ ਕੇ ਅਤੇ ਇੱਕ ਬੰਦਾ ਉਹਨੂੰ ਪਕੜ ਲੈਂਦਾ ਸੀ ਅਤੇ ਅਸੀਂ ਸਾਰੀਆਂ ਜੁੱਤੀਆਂ ਇਕੱਠੀਆਂ ਕਰਕੇ ਅਤੇ ਫਿਰ ਅਸੀਂ ਉੱਤੋਂ ਜੁੱਤੀ ਚੱਕਦੇ ਸੀ ਅਤੇ ਜਿਹੜਾ ਉਹ ਸਾਨੂੰ ਜੁੱਤੀਆਂ ਮਤਲਬ ਉਹ ਰੋਕਦਾ ਸੀਗਾ ਜੇਕਰ ਅਸੀਂ ਸਾਰੀਆਂ ਜੁੱਤੀਆਂ ਚੱਕ ਲੈਂਦੇ ਸੀ ਤਾਂ ਉਹ ਭੱਜ ਲੈਂਦਾ ਸੀ ਪਿੱਛੇ ਮਾ ਭੱਜਦੇ ਸੀਗੇ ਅਤੇ ਉਹ ਅਸ ਅਸੀਂ ਉਹਦੇ ਸਾਰੇ ਜੁੱਤੀਆਂ ਮਾਰਦੇ ਸੀ ਜਿਹੜਾ ਪਿੱਠੂ ਵਗੈਰਾ ਮੈਂ ਉਹਦੇ ਇੱਕ ਜਗ੍ਹਾ 'ਤੇ ਵੀਟੀਆਂ ਰੱਖ ਲੈਂਦੇ ਹੈ ਅਤੇ ਪਿੱਠੂ ਮਾਰਦੇ ਹੈ ਜਦੋਂ ਫਿਰ ਪਿੱਠ ਜਿਹੜਾ ਪਿੱਠੂ ਬਣਾਉਂਦਾ ਹੈ ਓਹ ਹ ਉਹ ਟੀਮ ਜਿੱਤ ਜਾਂਦੀ ਹੈ